ਹਾਂਜੀ ਛੋਟੇ ਹੁੰਦੇ ਜਿਹੜੇ ਹੈ ਕੁਛ ਨਾ ਕੁਛ ਇੱਦਾਂ ਦਾ ਜਿਵੇਂ ਬੱਚੇ ਕਰਦੇ ਹੁੰਦੇ ਉਸ ਸਮੇਂ ਜਿਹੜੀ ਹੈ ਕੁਛ ਮੂਰਤੀਆਂ ਵਗੈਰਾ ਜਾਂ ਕੁਛ ਖਿਡੌਣੇ ਵਗੈਰਾ ਮਿੱਟੀ ਦੇ ਖਿਡੌਣੇ ਵਗੈਰਾ ਬਣਾਉਣੇ ਓਦਾਂ ਦੀਆਂ ਚੀਜ਼ਾਂ ਬਣਾਈਆਂ ਸੀਗੀਆਂ ਅਤੇ ਉਹ ਜਿਵੇਂ ਬੱਚੇ ਖੇਡਦੇ ਹੁੰਦੇ ਆ ਤਾਂ ਕੁਛ ਮਿੱਟੀ ਲੈ ਕੇ ਕੁਛ ਗੁੱਡੀ ਜਾਂ ਕੁਛ ਹੋਰ ਬਣਾਉਣੇ ਉਹ ਬਣਾਉਂਦੇ ਤਾਂ ਉਸ ਸਮੇਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਘਰਦੇ ਜਿਹੜੇ ਹੁੰਦੇ ਸੀ ਉਹ ਲੜਦੇ ਵੀ ਮਿੱਟੀ 'ਚ ਕਿਹੜਾ ਹੈ ਤੂੰ ਖੇਡੀ ਜਾਂਦਾ ਮਿੱਟੀ 'ਚ ਲਿਬੜੀ ਜਾਂਦਾ ਗਾ ਇਸ ਤੋਂ ਇਲਾਵਾ ਜਿਹੜੇ ਮਿੱਟੀ ਨੂੰ ਜਦੋਂ ਗੁੰਨਿਆ ਗੁੰਨਦੇ ਤਾਂ ਮਿੱਟੀ ਨੂੰ ਜਦੋਂ ਗੁੰਨਿਆ ਜਾਂਦਾ ਤਾਂ ਕਈ ਵਾਰ ਪਾਣੀ ਵੱਧ ਪੈ ਜਾਂਦਾ ਕਦੇ ਮਿੱਟੀ ਘੱਟ ਰਹਿ ਜਾਂਦੀ ਜਾਂ ਕਈ ਵਾਰ ਮਿੱਟੀ ਵੱਧ ਜਾਂਦੀ ਪਾਣੀ ਘੱਟ ਜਾਂਦਾ ਇਸ ਤਰੀਕੇ ਨਾਲ ਉਹਨੂੰ ਛਾਨਣ ਦੇ ਵਿੱਚ ਕੋਈ ਰੋੜ ਆ ਗਏ ਉਹਦੇ ਵਿੱਚ ਤਾਂ ਇਸ ਤਰੀਕੇ ਨਾਲ ਕਾਫੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਅਸੀਂ ਉਹ ਸਾਹਮਣਾ ਕਰਨਾ ਪੈਂਦਾ ਅਤੇ ਮੇਨ ਲੀਡ ਹੈ ਕਿ ਖੇਡ ਦੇ ਪਰਪਸ ਤੋਂ ਹੀ ਜਿਹੜੀਆਂ ਇੱਦਾਂ ਦੇ ਕੁਛ ਮੂਰਤੀ ਵਗੈਰਾ ਉੱਦੋਂ ਬਣਾਈ ਹੁੰਦੀ ਸੀ ਉਹ ਮੂਰਤੀਆਂ ਬਣਾਈਆਂ